ਮੈਂ ਇੰਸਟਾਗ੍ਰਾਮ ਚਲਾਉਂਦਾ ਹਾਂ ਮੈਂ ਲੋਕਾਂ ਦੀਆਂ ਵੀਡੀਓ ਬਹੁਤ ਦੇਖਦਾ ਹਾਂ ਬਹੁਤ ਵਧੀਆ ਵਧੀਆ ਡਾਂਸ ਕਰਦੇ ਆ ਬਹੁਤ ਵਧੀਆ ਹਾਸੇ ਵਾਲੀਆਂ ਵੀਡੀਓ ਵੀ ਪਾਉਂਦੇ ਆ ਨੱਚਣ ਵਾਲੀਆਂ ਪਾਉਂਦੇ ਆ ਵੈਸੇ ਨੱਚਣ ਵਾਲੀਆਂ ਜ਼ਿਆਦਾ ਵਧੀਆ ਹੁੰਦੀਆਂ ਜੀ ਅਤੇ ਮੈਨੂੰ ਵੀ ਵੈਸੇ ਡਾਂਸ ਆਉਂਦਾ ਜੀ ਵਿਆਹਾਂ ਸ਼ਾਦੀਆਂ 'ਚ ਮੈਂ ਬਹੁਤ ਨੱਚਦਾ ਆਪਣੀ ਫੈਮਲੀ ਨਾਲ ਬਹੁਤ ਨੱਚਦਾ ਪਰ ਮੈਂ ਕਦੇ ਇੰਸਟਾਗ੍ਰਾਮ 'ਤੇ ਵੀਡੀਓ ਨਹੀਂ ਪਾਈ ਮੇਰੇ ਬੱਚੇ ਇੰਸਟਾਗ੍ਰਾਮ ਚਲਾਉਂਦੇ ਮੇਰੀ ਬੇਟੀ ਬਹੁਤ ਵਧੀਆ ਕਰਦੀ ਆ ਉਹਦੇ ਵਿੱਚ ਕਲਾ ਹੈਗੀ ਵੀਡੀਓ ਪਾਉਣ ਦੀ ਬਹੁਤ ਵਧੀਆ ਬਣਾਉਂਦੀ ਆ ਪਰ ਮੈਂ ਕਦੇ ਨਹੀਂ ਵੀਡੀਓ ਵੀਡੀਓ ਪਾਈ